ਕਣਕ ਨੂੰ ਉਗਾਉਣ ਲਈ ਸਭ ਤੋਂ ਪਹਿਲਾਂ ਇਹ ਆਪਣੀ ਮਿੱਟੀ ਨੂੰ ਉਪਜਾਊ ਬਣਾਉਂਦੇ ਹਾਂ ਮਿੱਟੀ ਨੂੰ ਜਦੋਂ ਉਪਜਾਊ ਬਣਾ ਦਿੱਤਾ ਜਾਵੇ ਫਿਰ ਉਹਦੇ ਵਿੱਚ ਅਸੀਂ ਬੀਜਾਂ ਨੂੰ ਸੁੱਟਦੇ ਹਾਂ ਬੀਜ ਜਦੋਂ ਚੰਗੀ ਤਰ੍ਹਾਂ ਸੁੱਟ ਦਿੱਤੇ ਜਾਣ ਸਾਰੇ ਪਾਸੇ ਖਿਲਾਰ ਦਿੱਤੇ ਜਾਣ ਬੀਜ ਫਿਰ ਬਾਦ ਵਿੱਚ ਉਹਦੇ ਵਿੱਚ ਪਾਣੀ ਲਗਾਇਆ ਜਾਂਦਾ ਹੈ ਹੌਲੀ ਹੌਲੀ ਪਾਣੀ ਦਿੱਤਾ ਜਾਂਦਾ ਹੈ ਤਾਂ ਕਿ ਜਿਹੜੀ ਸਾਡੇ ਬੀਜ ਹੈ ਉਹ ਉੱਗ ਸਕਣ ਪਾਣੀ ਜਦੋਂ ਪਾਣੀ ਦੇਣ ਵੇਲੇ ਅਸੀਂ ਬਹੁਤ ਖਾਸ ਕਰਕੇ ਧਿਆਨ ਦੇਣਾ ਹੈ ਕਿ ਪਾਣੀ ਸਹੀ ਮਾਤਰਾ ਵਿੱਚ ਪਏ ਅਤੇ ਸਹੀ ਟਾਈਮ 'ਤੇ ਉਹਨੂੰ ਪਾਣੀ ਮਿਲਦਾ ਰਹੇ ਤਾਂ ਕਿ ਜੋ ਕਿ ਫਸਲ ਚੰਗੀ ਤਰ੍ਹਾਂ ਉੱਗ ਜਾਏ ਫਿਰ ਥੋੜ੍ਹੇ ਚਿਰ ਬਾਅਦ ਅਸੀਂ ਹੌਲੀ ਹੌਲੀ ਉਹਦੇ ਵਿੱਚ ਖਾਦ ਦਾ ਪ੍ਰਯੋਗ ਕੀਤਾ ਕਰਦੇ ਹਾਂ ਜਿਹੜੀ ਕਿ ਖਾਦ ਸਾਡੀ ਫ਼ਸਲ ਨੂੰ ਹੋਰ ਚੰਗੀ ਤਰ੍ਹਾਂ ਉਗਾਉਣ ਵਿੱਚ ਮਦਦ ਕਰਦੀ ਹੈ ਥੋੜ੍ਹੇ ਚਿਰਾਂ ਬਾਅਦ ਜਦੋਂ ਬੀਜਾਂ 'ਚੋਂ ਕਣਕ ਦੇ ਪੌਦੇ ਨਿਕਲਣੇ ਸ਼ੁਰੂ ਹੋ ਜਾਂਦੇ ਅਤੇ ਫਿਰ ਕਣਕ ਹੌਲੀ ਹੌਲੀ ਉੱਗਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਹਦੇ ਵਿੱਚ ਪਾਣੀ ਹੌਲੀ ਹੌਲੀ ਦਿੱਤਾ ਜਾਂਦਾ ਹੈ ਅਤੇ ਖਾਦ ਉਹਦੇ ਵਿੱਚ ਥੋੜ੍ਹੇ ਥੋੜ੍ਹੇ ਦਿੱਤੇ ਜਾਂਦੇ ਹੈ ਜਦੋਂ ਕਣਕ ਚੰਗੀ ਤਰ੍ਹਾਂ ਪੱਕ ਜਾਂਦੀ ਹੈ ਅਤੇ ਫਿਰ ਉਹਦੀ ਵਾਢੀ ਕਰਨ ਲਈ ਬਹੁਤ ਖਾਸ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ ਜਿਵੇਂ ਕਣਕ ਦੀ ਵਾਢੀ ਕਰਨ ਸਮੇਂ ਅਸੀਂ ਪਹਿਲੇ ਕਣਕ ਨੂੰ ਜ਼ਮੀਨ ਤੋਂ ਅਲੱਗ ਕਰ ਦਿੰਦੇ ਹਾਂ ਫਿਰ ਉਨ੍ਹਾਂ ਦੀਆਂ ਗੁੱਛੀਆਂ ਜਿਹੀਆਂ ਬਣਾ ਕੇ ਉਨ੍ਹਾਂ ਨੂੰ ਖੇਤਾਂ ਵਿੱਚ ਰੱਖਦੇ ਹਾਂ ਫਿਰ ਬਾਅਦ ਵਿੱਚ ਕਣਕ ਦੇ ਬੀਜਾਂ ਨੂੰ ਅਤੇ ਪੌਦਿਆਂ ਨੂੰ ਅਲੱਗ ਕੀਤਾ ਜਾਂਦਾ ਹੈ ਇਸ ਤਰ੍ਹਾਂ ਸਾਡੀ ਕਣਕ ਦੀ ਜਿਹੜੀ ਹੈ ਉਹ ਕਟਾਈ ਹੁੰਦੀ ਹੈ ਅਤੇ ਚੰਗੀ ਤਰ੍ਹਾਂ ਕਣਕ ਸਾਡੀ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਫਿਰ ਬਾਅਦ ਵਿੱਚ ਮੰਡੀਆਂ ਵਿੱਚ ਵੇਚਣ ਲਈ ਭੇਜਿਆ ਜਾਂਦਾ ਹੈ ਇਸ ਤਰ੍ਹਾਂ ਸਾਡੀ ਕਣਕ ਦੀ ਉਗਾਉਣ ਤੱਕ ਕਣਕ ਨੂੰ ਉਗਾਉਣ ਤੱਕ ਅਤੇ ਕਣਕ ਦੀ ਵਾਢੀ ਕਰਨ ਤੱਕ ਇਹ ਸਾਰੇ ਕੰਮ ਹੁੰਦੇ ਹਨ